ਜਦੋਂ ਮੈਂ ਮਾਰਸ਼ਲ ਆਰਟ ਦੀ ਵਿਸ਼ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਉਸ ਸਮੇਂ ਮੇਰੀ ਉਮਰ ਛੇ ਸਾਲ ਸੀ ਮੈਂ ਛੋਟਾ ਸੀ ਮੈਂ ਆਪਣੇ ਚਾਚਾ ਜੀ ਨੂੰ ਖੇਡਦਾ ਦੇਖਦਾ ਹੁੰਦਾ ਸੀ ਬਿਕੋਸ ਮੇਰੇ ਚਾਚਾ ਜੀ ਦੇ ਜਿਹੜੇ ਗੁਰੂ ਨੇ ਉਸਤਾਦ ਜੀ ਨੇ ਉਹ ਮੇਰੇ ਦਾਦਾ ਜੀ ਸੀ ਉਹ ਉਹਨਾਂ ਨੂੰ ਸਿਖਾਉਂਦੇ ਹੁੰਦੇ ਸੀ ਮੈਂ ਉਹਨਾਂ ਦੇਖਦਾ ਹੁੰਦਾ ਸੀ ਮੈਂ ਵੀ ਕਹਿੰਦਾ ਸੀ ਕਿ ਮੈਂ ਆਹ ਚੀਜ਼ ਸਿੱਖਣੀ ਹੈ ਕਿ ਮੈਨੂੰ ਇਸ ਤੋਂ ਕੋਈ ਨੌਲੇਜ ਮਿਲੇਗੀ ਜਾਂ ਮੇਰੇ ਅੱਗੇ ਜਾ ਕੇ ਕੰਮ ਆਏਗੀ ਮੈਂ ਛੇ ਸਾਲ ਦੀ ਉਮਰ ਤੋਂ ਇਹ ਸਿੱਖਣਾ ਸ਼ੁਰੂ ਕੀਤਾ ਮੈਨੂੰ ਸ਼ੁਰੂ ਸ਼ੁਰੂ 'ਚ ਬਹੁਤ ਡਿਫੀਕਲਟੀ ਫੇਸ ਕਰਨੀ ਪਈ ਕਿਉਂਕਿ ਕੋਈ ਚੀਜ਼ ਸਿੱਖਣੀ ਹੁੰਦੀ ਉਹਦੇ ਵਾਸਤੇ ਤੁਹਾਨੂੰ ਪਤਾ ਕੋਈ ਨਾ ਕੋਈ ਆਪਾਂ ਨੂੰ ਖ਼ਤਰਾ ਜਾਂ ਕੋਈ ਮੂਲ ਲੈਣਾ ਪੈਂਦਾ ਹੈ ਜਾਂ ਕੋਈ ਡਿਫੀਕਲਟੀ ਫੇਸ ਕਰਨੀ ਪੈਂਦੀ ਹੈ ਅਤੇ ਮੇਰੇ ਦਾਦਾ ਜੀ ਨੇ ਮੈਨੂੰ ਪਹਿਲਾਂ ਇਸ ਮਾਰਸ਼ਲ ਆਰਟ 'ਚ ਅਤੇ ਸਾਡੇ ਵਾਲੀ ਤਾਂ ਮਾਰਸ਼ਲ ਆਰਟ ਹੈ ਵੀ ਇਸ ਸਾਲ ਸੀ ਦਾਦਾ ਜੀ ਨੇ ਸਾਨੂੰ ਬਹੁਤ ਕੁੱਟਿਆ ਭਜਾ ਭਜਾ ਕੇ ਕੁੱਟਿਆ ਕਿਉਂਕਿ ਸਾਡੇ ਕੋਲ ਕਈ ਵਾਰੀ ਜਦੋਂ ਅਸੀਂ ਮ ਲੇਟ ਹੋ ਜਾਂਦੇ ਸੀ ਜਾਂ ਕਿਉਂਕਿ ਹਰ ਗੇਮ ਦਾ ਇੱਕ ਰੂਲ ਹੁੰਦਾ ਜਾਂ ਮਾਰਸ਼ਲ ਆਰਟ ਹੋਵੇ ਜਾਂ ਕੋਈ ਵੀ ਹੋਵੇ ਕਿ ਟਾਈਮ ਦੇ ਪਾਬੰਦ ਰਹੋ ਅਤੇ ਆਪਣੇ ਗੋਲ 'ਤੇ ਫੋਕਸ ਕਰੋ ਇਸ ਤੋਂ ਬਿਨਾਂ ਆਪਾਂ ਕੁਛ ਨਹੀਂ ਕਰ ਸਕਦੇ ਇਸਦੇ ਵਿੱਚ ਮੇਨ ਗੱਲ ਆ ਧਿਆਨ ਦੀ ਅਤੇ ਜੇ ਧਿਆਨ ਲਾ ਕੇ ਆਪਾਂ ਕਰਾਂਗੇ ਉਹ ਚੀਜ਼ ਆਪਣੇ ਦਿਮਾਗ 'ਚ ਫਿੱਟ ਹੈ ਅਤੇ ਆ ਗੁਣ ਕਿਤੇ ਜਾਂਦਾ ਨਹੀਂ ਆਪਣੇ ਹੱਥ ਦੇ ਵਿੱਚ ਹੀ ਰਹਿੰਦਾ ਇਹ ਸਾਨੂੰ ਬਚਪਨ ਤੋਂ ਸਿੱਖਿਆ ਪੜ੍ਹਾਈ ਗਈ ਹੈ ਜੀ ਸ਼ੁਰੂਆਤੀ ਦਿਨਾਂ 'ਚ ਮੈਨੂੰ ਇਹ ਚੀਜ਼ਾਂ ਸਿਖਾਈਆਂ ਗਈਆਂ ਸੀ